ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਠੀਕ ਹੈ ਵੀਰ ਜੀ ਹਾਂਜੀ ਦੱਸੋ ਜੀ ਹਾਂਜੀ ਵੀਰ ਜੀ ਦੱਸੋ ਜੀ ਠੀਕ ਹੈ ਵੀਰ ਜੀ ਸਾਡੇ ਨਾ ਇੱਥੇ ਵੀਰ ਜੀ ਬਰਨਾਲੇ ਸ਼ਹਿਰ ਦੇ ਵਿੱਚ ਸ਼ਰਮਾ ਡੈਅਰੀ ਆ ਜੀ ਠੀਕ ਹੈ ਜੀ ਉੱਥੇ ਦੁੱਧ ਪੂਰਾ ਵਧੀਆ ਮਿਲਦਾ ਜੀ ਦੁੱਧ ਦਹੀਂ ਠੀਕ ਹੈ ਘਿਓ ਸਾਰਾ ਕੁਝ ਪੂਰਾ ਵਧੀਆ ਪਿਓਰ ਮਿਲਦਾ ਜੀ ਪੂਰਾ ਵਧੀਆ ਮਿਲਦਾ ਜੀ ਕੋਈ ਲਾ ਹਾਂਜੀ ਵੀਰ ਜੀ ਪਨੀਰ ਵਧੀਆ ਸ਼ੁੱਧ ਦੁੱਧ ਦਾ ਕੱਢ ਕੇ ਵਧੀਆ ਦਿੰਦੇ ਆ ਜੀ ਠੀਕ ਹੈ ਵੀਰ ਜੀ ਅਤੇ ਇਹ ਸਾਰਾ ਕੁਝ ਵਧੀ ਅਤੇ ਦੁੱਧ ਦਹੀਂ ਵਧੀਆ ਦਿੰਦੇ ਰੇਟ ਬਿਲਕੁਲ ਰੇਟ ਬਿਲਕੁਲ ਜਾਇਜ਼ ਹੈ ਜੀ ਬਹੁਤ ਵਧੀਆ ਜੀ ਕੋਈ ਜ਼ਿਆਦਾ ਨਹੀਂ ਰੇਟ ਉਸਦੇ ਹਾਂਜੀ ਦੁੱਧ ਦਾ ਹਾਂਜੀ ਵੀਰ ਜੀ ਹਾਂਜੀ ਅ ਨਹੀਂ ਵੀਰ ਜੀ ਮਿਲਦੇ ਆ ਜੀ ਕੋਈ ਗੱਲ ਨਹੀਂ ਤੁਸੀਂ ਆ ਜਾਉ ਜੀ ਤੁਹਾਨੂੰ ਪੂਰਾ ਵਧੀਆ ਦੇ ਦਿੰਦੇ ਹੈ ਜੀ ਇਹ ਦੁੱਧ ਹਾਂਜੀ ਇੱਕ ਉਹਦੇ ਇੱਥੇ ਪਨੀਰ ਅਸੀਂ ਵਰਤਦੇ ਹਾਂ ਜੀ ਪਨੀਰ ਦੁੱਧ ਅਸੀਂ ਲੈਣ ਜਾਂਦੇ ਹਾਂ ਜੀ ਖੋਆ ਵਗੈਰਾ ਦੇਸੀ ਘਿਓ ਜੀ ਪੂਰਾ ਵਧੀਆ ਦਿੰਦੇ ਆ ਜੀ ਹਾਂਜੀ ਘਰੋਂ ਘਰ ਦੀਆਂ ਮੈਸਾਂ ਰੱਖੀਆਂ ਹੋਈਆਂ ਜੀ ਇਹਨਾਂ ਦੀਆਂ ਉੱਥੇ ਉਹ ਦੁੱਧ 'ਚ ਕਿਤੋਂ ਵੀ ਮਿਲਾਵਟ ਨਹੀਂ ਕੋਈ ਪਾਣੀ ਨਹੀਂ ਪਾਉਂਦੇ ਜੀ ਇਹ ਪੂਰਾ ਵਧੀਆ ਦਿੰਦੇ ਸਾਰਾ ਕੁਛ ਅੱਛਾ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਨਹੀਂ ਵੀਰ ਜੀ ਕੋਈ ਗੱਲ ਨਹੀਂ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜੀ ਦੁੱਧ ਲੈਣਾ ਦਹੀਂ ਲੈਣਾ ਜੀ ਪਨੀਰ ਲੈਣਾ ਜੀ ਖੋਆ ਲੈਣਾ ਜੀ ਕੁਛ ਵੀ ਲੈਣਾ ਜੀ ਸ਼ਰਮਾ ਡੈਅਰੀ ਤੋਂ ਇੱਕ ਵਾਰੀ ਟਰਾਈ ਕਰਕੇ ਦੇਖਿਓ ਜੀ ਤੁਹਾਨੂੰ ਪੂਰਾ ਵਧੀਆ ਮਿਲੂੰਗਾ ਜੀ ਨਹੀਂ ਨਹੀਂ ਨਹੀਂ ਨਹੀਂ ਵੀਰ ਜੀ ਬਿਲਕੁਲ ਵੀ ਮਿਲਾਵਟ ਨਹੀਂ ਮਿਲੂੰਗੀ ਤੁਹਾਨੂੰ ਕੋਈ ਉਲਾਂਭਾ ਨਹੀਂ ਮਿਲੂੰਗਾ ਜੀ ਇਸ ਚੀਜ਼ 'ਚ ਕਿ ਮਿਲਾਵਟ ਆ ਦੁੱਧ ਪਤਲਾ ਜਾਂ ਪਨੀਰ ਪਤਲਾ ਪੂਰਾ ਵਧੀਆ ਪਨੀਰ ਹੈ ਜੀ ਘਿਓ ਇਹਨਾਂ ਦਾ ਪੂਰਾ ਵਧੀਆ ਹੈ ਜੀ ਹਾਂਜੀ ਹਾਂਜੀ ਦੁ ਦਹੀਂ ਬਿਲਕੁਲ ਪੂਰੀ ਵਧੀਆ ਗਾੜ੍ਹੀ ਮਿਲੇਗੀ ਦਹੀਂ ਨਹੀਂ ਮਾੜੀ ਇੰਨੀ ਵਧੀਆ ਮਿਲੇਗੀ ਦਹੀਂ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਟਰਾਈ ਕਰਕੇ ਦੇਖੇਓ ਦੇਸੀ ਘਿਓ ਹਾਂਜ ਨਹੀਂ ਜੀ ਬਿਲਕੁਲ ਵੀ ਬਿਲਕੁਲ ਵੀ ਨਹੀਂ ਮਿਲਾਵਟ ਵਾਲੀ ਚੀਜ਼ ਆ ਜੀ ਘਰ ਦਾ ਸ਼ੁੱਧ ਇਹ ਚੀਜ਼ ਕੱਢ ਕੇ ਦਿੰਦੇ ਨੇ ਹਾਂਜੀ ਪੂਰਾ ਵਧੀਆ ਸਾਰਾ ਕੁਝ ਦਿੰਦੇ ਆ ਜੀ ਤੁਸੀਂ ਇੱਕ ਵਾਰੀ ਟਰਾਈ ਕਰਿਓ ਜੀ ਸ਼ਰਮਾ ਡੈਅਰੀ ਤੋਂ ਜੀ ਠੀਕ ਠੀਕ ਠੀਕ ਹੈ ਜੀ ਥੈਂਕ ਯੂ ਜੀ ਠੀਕ ਠੀਕ ਠੀਕ